ਜੋ ਵੀ ਸਾਡੇ ਜੀਵਨ ਵਿੱਚ ਹੁੰਦਾ ਹੈ ਵੈਸੇ ਸ਼ੁਭ ਹੀ ਹੁੰਦਾ ਹੈ ਪਰ ਜਿਵੇਂ ਕਿ ਕੁਛ ਚੀਜ਼ਾਂ ਜਿਵੇਂ ਆਪਾਂ ਸ਼ੁਭ ਸ਼ੁਰੂਆਤ ਕਰਨੀ ਹੈ ਤਾਂ ਅਸੀਂ ਆਪਣੇ ਪਰਮਾਤਮਾ ਦਾ ਨਾਮ ਲੈਂਦੇ ਹਾਂ ਉਹਨੂੰ ਧਿਆਉਂਦੇ ਹਾਂ ਕਿ ਸਾਡੇ ਕੰਮ ਵਿੱਚ ਬਰਕਤ ਪਾਵੇ ਅਰਦਾਸ ਕਰਦੇ ਉਹਦੇ ਅੱਗੇ ਕਿ ਸਾਨੂੰ ਇੱਦਾਂ ਹੀ ਇਹ ਕੰਮ ਕਰਨ ਦੀ ਬਰਕਤ ਦੇਵੇ ਅਤੇ ਵਾਧਾ ਕਰੇ ਇਸ 'ਚ ਅਤੇ ਜਿਵੇਂ ਹਰ ਇੱਕ ਲਈ ਸ਼ੁਰੂਆਤ ਅਲੱਗ ਹੁੰਦੀ ਹੈ ਜਿਵੇਂ ਕਿ ਕਿਸੇ ਛੋਟੀ ਜਿਹੀ ਮੁਸਕਾਨ ਨਾਲ ਵੀ ਸਾਡੀ ਸ਼ੁਭ ਸ਼ੁਰੂਆਤ ਹੋ ਜਾਂਦੀ ਹੈ ਜਿਵੇਂ ਕਿਸੇ ਪਿਆਰ ਦੀ ਸ਼ੁਰੂਆਤ ਹੁੰਦੀ ਹੈ ਜਾਂ ਕਿਸੇ ਨਵੀਂ ਦੋਸਤੀ ਦਾ ਜਨਮ ਹੁੰਦਾ ਹੈ ਇਸੇ ਤਰ੍ਹਾਂ ਹੀ ਸਾਡੇ ਜੀਵਨ ਦੀ ਪਹਿਚਾਣ ਵੀ ਬਣ ਜਾਂਦੀ ਹੈ ਚੀਜ਼ ਇਹ ਮੇਰੇ ਜੀਵਨ ਵਿੱਚ ਸਜਾਵਟ ਦੀ ਸ਼ੁਰੂਆਤ ਕਰਦੀ ਹੈ ਅਤੇ ਅਸੀਂ ਹਰ ਘਟਨਾ ਨੂੰ ਯਾਦਗਾਰ ਹੀ ਮੰਨਦੇ ਹਾਂ ਅਤੇ ਹਰ ਕੰਮ ਨੂੰ ਅਸੀਂ ਸ਼ੁਰੂ ਕਰਨ ਵੇਲੇ ਹਮੇਸ਼ਾਂ ਆਪਣੇ ਵਾਹਿਗੁਰੂ ਪਰਮਾਤਮਾ ਨੂੰ ਧਿਆਉਂਦੇ ਹਾਂ ਅਤੇ ਹਮੇਸ਼ਾਂ ਉਸ ਦੇ ਹੀ ਸਹਿਯੋਗ ਨਾਲ ਅਸੀਂ ਉਸ ਕੰਮ ਨੂੰ ਐਂਡ ਤੱਕ ਵੀ ਪਹੁੰਚਾਉਂਦੇ ਹਾਂ